ਹੈਲੋ ਹਾਂਜੀ ਨਮਸਤੇ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਸੱਤ ਸੌ ਰੁਪਈਆ ਪੰਜ ਸੌ ਰੁਪਈਆ ਡਰਾਈ ਫਰੂਟ ਕਾਜੂ ਬਦਾਮ ਅਖਰੋਟ ਸਭ ਕੁਛ ਖੋਇਆ ਵੀ ਪਾਉਂਦੇ ਹਾਂ ਵਧੀਆ ਬਣਾਉਂਦੇ ਬਣਦੀ ਹੈ ਸਾਡੇ ਨਹੀਂ ਕੋਈ ਨਹੀਂ ਜਦੋਂ ਤੁਸੀਂ ਜ਼ਿਆਦਾ ਬਣਵਾਓਗੇ ਤਾਂ ਲੈਸ ਕਰ ਦਿਆਂਗੇ ਸੌ ਪੰਜਾਹ ਲੈਸ ਕਰ ਦਿਆਂਗੇ ਹਮ ਹਾਂਜੀ ਹਾਂ ਹਾਂਜੀ ਉਹੀ ਪੰਜਾਹ ਰੁਪਏ ਡੱਬਾ ਘਟਾ ਦਿਆਂਗੇ ਕੋਈ ਗੱਲ ਨਹੀਂ ਐਡਵਾਂਸ ਦੇਣੇ ਤਾਂ ਐਡਵਾਂਸ ਦੇ ਦਿਆ ਜੇ ਬਾਅਦ 'ਚ ਦੇਣੇ ਤਾਂ ਬਾਅਦ 'ਚ ਦੇ ਦਿਓ ਜੀ

ਹਾਂਜੀ ਕੋਈ ਗੱਲ ਨਹੀਂ ਹਾਂਜੀ ਕੋਈ ਗੱਲ ਨਹੀਂ ਹਾਂ ਹਾਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵਧੀਆ ਹਾਂਜੀ ਕੋਈ ਗੱਲ ਨਹੀਂ